ਹੈਲੋ ਹਾਂਜੀ ਤੁਸੀਂ ਫੋਨ ਕੀਤਾ ਸੀ ਅੱਛਾ ਅੱਛਾ ਹਾਂ ਅਸੀਂ ਉਹਨਾਂ ਲਈ ਕਾਫ਼ੀ ਪ੍ਰਬੰਧ ਕੀਤੇ ਸੀਗੇ ਜਿਵੇਂ ਹੈਲੀਕਾਪਟਰ ਆਉਂਦਾ ਸੀ ਉਹਨਾਂ ਨੂੰ ਖਾਣਾ ਦੇ ਕੇ ਜਾਂਦਾ ਸੀਗਾ ਦੋ ਤਿੰਨ ਦਿਨਾਂ ਬਾਅਦ ਆਉਂਦਾ ਹੁੰਦਾ ਸੀ ਉਹਨਾਂ ਸਾਰਿਆਂ ਨੂੰ ਖਾਣਾ ਦੇ ਕੇ ਜਾਂਦਾ ਸੀਗਾ ਜਿਹੜੇ ਆਪਣੀਆਂ ਛੱਤਾਂ 'ਤੇ ਸੀਗੇ ਜਿਹੜੇ ਦੂਜੇ ਥਾਂ 'ਤੇ ਗਏ ਸੀਗੇ ਜਿਨ੍ਹਾਂ ਕੋਲ ਕਿਤੇ ਥਾਂ ਨਹੀਂ ਸੀਗੇ ਰਹਿਣ ਨੂੰ ਉਹਨੂੰ ਅਸੀਂ ਦੂਜੇ ਏਰੀਏ 'ਚ ਸ਼ਿਫਟ ਕਰਤਾ ਸੀਗਾ ਕਿ ਉੱਤੇ ਜਿੰਨੀ ਦੇਰ ਤੱਕ ਪਾਣੀ ਦਾ ਲੈਵਲ ਡਾਊਨ ਨਹੀਂ ਹੁੰਦਾ ਉੱਥੇ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਉੰਨੀ ਦੇਰ ਤੱਕ ਆਪਣੀ ਲਾਈਫ ਚੰਗੀ ਤਰ੍ਹਾਂ ਉੱਥੇ ਜੀਅ ਸਕਣ ਪਹਿਲਾਂ ਜਿਹੜੇ ਸਾਡੇ ਪਹਿਲਾਂ ਜਿਹੜੇ ਸਾਡੇ ਸੀਨੀਅਰਸ ਹੈਗੇ ਆ ਨਾ ਉਹ ਥੋੜ੍ਹੇ ਜਿਹੇ ਖਰਾਬ ਸੀਗੇ ਉਹਨੇ ਡਿਪਾਰਟਮੈਂਟ ਨੇ ਕੁਛ ਚੇੰਜਸ ਕੀਤੇ ਹੈ ਜਿਹੜੇ ਸਾਡੇ ਸੀਨੀਅਰ ਹੈਗੇ ਆ ਉਹਨਾਂ ਨੂੰ ਕਾਫ਼ੀ ਸਟਰਿਕਟ ਵਾਰਨਿੰਗ ਦਿੱਤੀ ਹੈਗੀ ਆ ਜੇ ਐਵੇਂ ਦਾ ਕੁਛ ਹੋਇਆ ਦੁਬਾਰਾ ਤਾਂ ਉਹਨਾਂ ਨੂੰ ਹਟਾ ਦਿੱਤਾ ਜਾਊਗਾ ਉਹਨਾਂ ਨੂੰ ਪੈਸੇ ਦਾ ਜੁਰਮਾਨਾ ਵੀ ਉਹਨਾਂ ਨੇ ਹੁਣ ਕਾਫ਼ੀ ਭਰਿਆ ਹੈਗਾ ਜਿਵੇਂ ਪਹਿਲਾਂ ਜਿਹੜੇ ਸਾਡੇ ਸੀਨੀਅਰਸ ਹੈਗੇ ਆ ਇੰਨੇ ਕੁ ਦੇ ਸਕਦੇ ਸੀ ਕਿਉਂਕਿ ਸਾਡਾ ਵੀ ਹੱਥ ਹੁਣ ਬੰਨਿਆ ਸੀਗਾ ਅਸੀਂ ਵੀ ਉੰਨਾ ਕੁ ਹੀ ਕੰਮ ਕਰ ਸਕਦੇ ਸੀ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਕਿਉਂਕਿ ਅਸੀਂ ਹੱਦ ਤੋਂ ਵੱਧ ਕਰਾਂਗੇ ਤਾਂ ਅਸੀਂ ਵੀ ਫਿਰ ਪੰਗੇ 'ਚ ਪੈ ਸਕਦੇ ਹਾਂ ਸਾਨੂੰ ਵੀ ਫਿਰ ਅਸੀਂ ਵੀ ਕਿਸੇ ਨੂੰ ਜਵਾਬ ਦੇਣਾ ਹੁੰਦਾ ਅੱਗੇ ਅਗਲੀ ਵਾਰ ਹੁਣ ਅਸੀਂ ਕਾਫ਼ੀ ਕੁਛ ਵੈਸੇ ਸੁਧਾਰ ਕਰ ਦਿੱਤੇ ਜਿਹੜੇ ਪਾਈਪਾਂ ਹੁੰਦੀਆਂ ਉਹਨਾਂ ਦਾ ਜਿਹੜੀ ਸਾਈਜ਼ ਹੁੰਦੀ ਆ ਉਹ ਵੱਡੀਆਂ ਕਰਤੀਆਂ ਹੈਗੀਆਂ ਸਾਫ਼ ਰੱਖਦੇ ਹੈਗੇ ਆ ਜਿਹੜਾ ਡੈਮ ਹੈਗਾ ਜਿਹੜਾ ਉਹ ਰੈਗੂਲਰਲੀ ਸਾਫ਼ ਕਰਦੇ ਰਹਿੰਦੇ ਹੈਗੇ ਆ ਠੀਕ ਹੈ ਧੰਨਵਾਦ